ਭਾਰਤ ਇੱਕ ਅਜਿਹਾ ਮੁਲਕ ਹੈ ਜਿੱਥੇ ਬਹੁਤ ਧਰਮਾਂ ਦੇ ਲੋਕ ਰਹਿੰਦੇ ਹਨ ਸਭ ਲੋਕ ਆਪਣੇ ਆਪਣੇ ਧਰਮ ਦਾ ਆਦਰ ਕਰਦੇ ਹਨ ਪਰ ਕਈ ਵਾਰ ਰਾਜਨੀਤੀ ਲੋਕ ਧਰਮ ਦੇ ਨਾਂ 'ਤੇ ਲੋਕਾਂ ਨੂੰ ਬੜਾ ਦਿੰਦੇ ਹਨ ਉਹਨਾਂ ਵਿੱਚ ਨਫਰਤ ਪੈਦਾ ਕਰਦੇ ਹਨ ਅਤੇ ਆਪਣਾ ਫਾਇਦਾ ਲੈ ਲੈਂਦੇ ਹਨ ਇਸ ਲਈ ਧਰਮ ਨੂੰ ਕਈ ਵਾਰ ਵਾ ਵਾਪਸ ਬਾਹਰ ਲਈ ਵੀ ਵਰਤਿਆ ਜਾਂਦਾ ਜਾਂਦਾ ਹੈ ਇਹ ਬਹੁਤ ਹੀ ਗਲਤ ਕੰਮ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾਉਣਾ ਨਹੀਂ ਚਾਹੀਦਾ